ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਫਤਿਹਗੜ੍ਹ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਬਾਹਰ ਖੜ੍ਹੀ ਹਾਂ ਅਤੇ ਮੈਂ ਜਿਹੜੀ ਮੇਰੇ ਗੂਗਲ ਮੈਪ 'ਤੇ ਸਭ ਤੋਂ ਨੇੜੇ ਪੰਜ ਮਿੰਟ ਦੂਰ ਸਵੀਡਨ ਕਾਰ ਦਿਖਾਈ ਜਾ ਰਹੀ ਉਹਨੂੰ ਆਪਣੀ ਕੈਬ ਵਜੋਂ ਬੁੱਕ ਕਰਨਾ ਚਾਹੁੰਦੀ ਹਾਂ ਹਾਂਜੀ ਮੈਂ ਲੁਧਿਆਣੇ ਜਾਣਾ ਚਾਹੁੰਦੀ ਹਾਂ ਮੋਡਲ ਟਾਊਨ ਵਿਖੇ ਅਤੇ ਇੱਥੋਂ ਡੇਢ ਕੁ ਘੰਟੇ ਦਾ ਸਫ਼ਰ ਹੈ ਹਾਂਜੀ ਕੀ ਤੁਹਾਨੂੰ ਪਤਾ ਇੱਥੇ ਹੋਰ ਨੇੜੇ ਅੋਟੋ ਕਿੱਥੋਂ ਮਿਲੇਗਾ ਅਤੇ ਕਿੱਥੇ ਤੱਕ ਮਿਲ ਸਕਦਾ ਕਿੰਨੇ ਰੁਪਿਆਂ 'ਚ ਹਾਂਜੀ ਹਾਂਜੀ ਲੁਧਿਆਣੇ ਮੋਡਲ ਟਾਊਨ ਗੁਰਦੁਆਰਾ ਸਾਹਿਬ ਦੇ ਨੇੜੇ ਜਿਹੜੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਬਿਲਡਿੰਗ ਹੈ ਉਹ ਇਮਾਰਤ ਦੇ ਨੇੜੇ ਹਾਂਜੀ ਰਾਹ ਦੇ ਵਿੱਚ ਦੋ ਥਾਂ ਰੁਕਣਾ ਵੀ ਹੈ ਜੇ ਸੰਭਵ ਹੋ ਸਕੇ ਤਾਂ ਉਹਨੂੰ ਵੀ ਜ਼ਰੂਰ 'ਚ ਧਿਆਨ 'ਚ ਰੱਖ ਲੈਣਾ ਹਾਂਜੀ ਜਿਹੜੀ ਸਭ ਤੋਂ ਨੇੜੇ ਵਾਲੀ ਕਾਰ ਹੋਵੇ ਕੋਈ ਵੀ ਸਵੀਡਨ ਜਾਂ ਪੰਜ ਸੌ ਤੱਕ ਜਿਹੜੀ ਵੀ ਕੈਬ ਬੁੱਕ ਹੋ ਰਹੀ ਹੈ ਉਹ ਕਿਰਪਾ ਕਰਕੇ ਮੇਰੀ ਬੁੱਕ ਕਰਨ 'ਚ ਮਦਦ ਕਰਨਾ ਠੀਕ ਹੈ ਜੀ ਧੰਨਵਾਦ